ਸਤਿ ਸ਼੍ਰੀ ਅਕਾਲ ਵੀਰੇ ਸੰਦੀਪ ਟੈਕਸੀ ਵਾਲਾ ਬੋਲ ਰਹੇ ਹੋ ਵੀਰੇ ਯਾਰ ਮੈਂ ਰਾਤ ਨਾ ਟੈਕਸੀ ਬੁੱਕ ਕਰਵਾਈ ਸੀ ਆਪਣੀ ਸਵੇਰੇ ਅੱਠ ਵਜੇ ਲਈ ਅਤੇ ਮੇਰਾ ਪੇਪਰ ਸੀਗਾ ਬੀ ਏ ਦਾ ਅਤੇ ਵੀਰੇ ਹੁਣ ਨੌ ਵੱਜ ਗਏ ਯਾਰ ਤੁਸੀਂ ਆਏ ਨੀਗੇ ਮੈਂ ਪਹਿਲਾਂ ਤੁਹਾਨੂੰ ਮਿਸਕੋਲਾਂ ਕਰੀਆਂ ਤੁਸੀਂ ਚੱਕ ਨਹੀਂ ਰਹੇ ਸੀਗੇ ਮਸਾਂ ਤੁਸੀਂ ਫੋਨ ਚੱਕਿਆ ਅਤੇ ਉੱਥੇ ਮੇਰੇ ਸਾਢੇ ਨੌ ਸਾਡੀ ਐਂਟਰੀ ਸ਼ੁਰੂ ਮਤਲਬ ਕਰ ਦਿੰਦੇ ਉਹਨਾਂ ਨੇ ਗੇਟ ਬੰਦ ਕਰ ਦਿੰਦੇ ਮੇਰੀ ਯਾਰ ਸਾਲ ਦੀ ਮਿਹਨਤ ਤੁਸੀਂ ਇਹ ਤਾਂ ਦੇਖ ਲਉ ਥੋੜ੍ਹਾ ਜਿਹਾ ਹੁਣ ਆਪਾਂ ਇੱਥੋਂ ਤੁਰਾਂਗੇ ਕਦੋਂ ਉੱਥੇ ਪਹੁੰਚਾਂਗੇ ਪਹੁੰਚਣ ਨੂੰ ਵੀ ਟਾਇਮ ਲੱਗੂਗਾ ਰਾਸਤੇ 'ਚ ਟਰੈਫਿਕ ਵਾਧੂੂ ਹੈ ਫਿਰ ਥੋੜ੍ਹਾ ਜਿਹਾ ਆਪ ਵੀ ਨਾ ਇਹ ਦੇਖਣਾ ਚਾਹੀਦਾ ਮੈਂ ਤੁਹਾਨੂੰ ਰਾਤ ਦੱਸ ਕੇ ਪਹਿਲਾਂ ਹੀ ਕਿਹਾ ਸੀ ਭਾਈ ਮੇਰਾ ਪੇਪਰ ਆ ਸਾਡੀ ਐਂਟਰੀ ਬੰਦ ਕਰ ਦਿੰਦੇ ਤੁਸੀਂ ਉੱਥੋਂ ਘੱਟੋ ਘੱਟ ਤੁਸੀਂ ਨਹੀਂ ਆ ਸਕਦੇ ਕਿਸੀ ਹੋਰ ਨੂੰ ਕਹਿ ਦਿੰਦੇ ਨਾ ਮੈਂ ਹੋਰ ਕਿਤੋਂ ਬੁੱਕ ਕਰਾ ਲੈਂਦਾ ਪਰ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਫੋਨ ਵੀ ਨਹੀਂ ਚੱਕਦੇ ਸਭ ਤੋਂ ਵੱਡੀ ਗਲਤ ਗੱਲ ਤਾਂ ਤੁਹਾਡੀ ਇਹ ਹੈ ਜੇ ਪੈਸੇ ਮੈਂ ਤੁਹਾਨੂੰ ਪਹਿਲੀ ਓ ਕਰ ਚੁੱਕਿਆ ਇਸ ਗੱਲ ਲਈ ਵੀ ਮੈਂ ਪੈਸੇ ਵੀ ਪਹਿਲਾਂ ਕਰਤੇ ਵੀ ਕਈ ਵਾਰ ਪੈਸਿਆਂ ਦਾ ਚੱਕਰ ਹੁੰਦਾ ਵੀ ਤੁਸੀਂ ਫਿਰ ਨਹੀਂ ਟਾਇਮ 'ਤੇ ਪਹੁੰਚ ਰਹੇ ਹੁਣ ਮੇਰਾ ਪੇਪਰ ਹੈ ਮੰਨ ਲਉ ਮੇਰੀ ਸਾਲ ਦੀ ਪੂਰੀ ਮਿਹਨਤ ਹੈ ਮੈਨੂੰ ਐਂਟਰੀ ਨਾ ਕਰਨ ਦੇਣ ਉਹ ਫਿਰ ਮੇਰਾ ਤਾਂ ਵੀਹ ਪੱਚੀ ਹਜ਼ਾਰ ਊ ਗਿਆ ਮੇਰਾ ਸਾਲ ਖ਼ਰਾਬ ਹੋ ਗਿਆ ਉਹ ਤੁਹਾਡੇ ਕਰਕੇ ਨਾ ਕਿੱਡੀ ਗਲਤ ਗੱਲ ਆ ਇਹ ਵੀ ਹੁਣ ਜਲਦੀ ਤੋਂ ਜਲਦੀ ਤੁਸੀਂ ਹੁਣ ਵੀ ਰੀਚ ਕਰ ਸਕਦੇ ਹੋ ਛੇਤੀ ਆ ਜੋ ਹੱਥ ਜੋੜ ਬੇਨਤੀ ਹੈ ਤੁਹਾਨੂੰ ਵੀ ਆਪਾਂ ਪਹੁੰਚ ਜੀਏ